ਮੈਂ ਆਪਣੇ ਵਿਹਲੇ ਸਮੇਂ ਦੌਰਾਨ ਸਮਾਂ ਕੁਝ ਇਸ ਤਰ੍ਹਾਂ ਬਤੀਤ ਕਰਦੀ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿੰਦੀ ਹਾਂ ਕਿ ਮੈਂ ਹਾਊਸਵਾਈਫ ਹਾਂ ਅਤੇ ਘਰ ਦਾ ਕੰਮ ਸਵੇਰ ਤੋਂ ਸ਼ੁਰੂ ਹੋ ਕੇ ਸ਼ਾਮ ਨੂੰ ਮੁੱਕਦਾ ਹੈ ਜਦੋਂ ਵੀ ਮੈਂ ਫ੍ਰੀ ਟਾਈਮ ਮਿਲਦਾ ਹੈ ਮੈਂ ਕੁਝ ਸਮਾਂ ਮਬੈਲ 'ਤੇ ਬਤੀਤ ਕਰਦੀ ਹਾਂ ਅਤੇ ਬਾਕੀ ਮੈਂ ਪਾਠ ਵੀ ਕਰ ਲੈਂਦੀ ਹਾਂ ਅਤੇ ਸ਼ਾਮ ਨੂੰ ਗੁਰੂ ਘਰ ਵੀ ਜਾਂਦੀ ਅਤੇ ਸਾਡੇ ਘਰ ਦੇ ਨਾਲ ਸਾਡੇ ਚਾਚਾ ਜੀ ਦਾ ਘਰ ਹੈ ਅਸੀਂ ਉੱਥੇ ਵੀ ਚਲੇ ਜਾਂਦੇ ਹਾਂ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਹਾਂ ਅਤੇ ਸ਼ਾਮ ਨੂੰ ਸੈਰ ਵੀ ਕਰਨ ਕਰਦੇ ਕਰਨ ਚਲੇ ਜਾਂਦੇ ਹਾਂ ਕੁਝ ਸਮਾਂ ਹੋਰ ਜਵਾਕਾਂ ਨਾਲ ਖੇਡ ਲੈਂਦੇ ਹਾਂ ਹੋਰ ਗੱਲਾਂ ਗੁੱਲਾਂ ਕਰ ਲੈਂਦੇ ਹਾਂ